ਬਾਈਕਿੰਗ ਦੇ ਮੁਕਾਬਲੇ ਇੱਕ ਬਹੁਤ ਹੀ ਜ਼ਿਆਦਾ ਮਨੋਰੰਜਕ ਈਵੈਂਟ ਹੁੰਦਾ ਹੈ ਇਸ ਵਿੱਚ ਬਹੁਤ ਸਾਰੀਆਂ ਬਾਈਕਾਂ ਆਪਸ ਵਿੱਚ ਰੇਸ ਲਾਉਂਦੀਆਂ ਹਨ ਅਤੇ ਅਗਰ ਆਪਾਂ ਇਸਦੀ ਇਨਵੈਂਸ਼ਨ ਬਾਰੇ ਗੱਲ ਕਰੀਏ ਤਾਂ ਬਾਈਕਿੰਗ ਇੱਕ ਬਹੁਤ ਹੀ ਵਧੀਆ ਅਤੇ ਮਿਡਲ ਕਲਾਸ ਵਿਅਕਤੀ ਵਾਸਤੇ ਇੱਕ ਯਾਤਾਯਾਤ ਦਾ ਸਾਧਨ ਹੈ ਇਸ ਨਾਲ ਵਿਅਕਤੀ ਬੜੇ ਆਰਾਮ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਆਰਾਮ ਨਾਲ ਪਹੁੰਚ ਸਕਦਾ ਹੈ ਅਤੇ ਅਗਰ ਮੈਂ ਗੱਲ ਕਰਾਂ ਕਿਸੇ ਈਵੈਂਟ ਬਾਰੇ ਤਾਂ ਇੱਕ ਵਾ ਇੱਕ ਵਾਰੀ ਸਾਡੇ ਕਾਲਜ ਵਿੱਚ ਕੇਟੀਐਮ ਦਾ ਇੱਕ ਟੋਰ ਅਨਾਊਂਸ ਹੋਇਆ ਸੀ ਇਸ ਵਿੱਚ ਅਸੀਂ ਮੋਹਾਲੀ ਦੇ ਪਹਾੜਾਂ ਵਿੱਚ ਗਏ ਸੀ ਅਤੇ ਮੇਰਾ ਇਹ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਸੀਗਾ ਕਿ ਬਾਈਕਿੰਗ ਕਰਦੇ ਹੋਏ ਅਸੀਂ ਪਹਾੜਾਂ ਵਿੱਚ ਘੁੰਮੇ ਅਤੇ ਉੱਥੇ ਬੜਾ ਵਧੀਆ ਸਟੇਅ ਲਿਤਾ ਸੀ ਅਤੇ ਮੈਨੂੰ ਬਹੁਤ ਵਧੀਆ ਲੱਗਿਆ ਸੀਗਾ ਉਸ ਦਿਨ ਕਿਉ ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਕੋਈ ਬਾਈਕਿੰਗ ਈਵੈਂਟ ਸੀਗਾ